ਨਮਸਕਾਰ ਸਰ ਮੈਂ ਦੋ ਘੰਟੇ ਪਹਿਲਾਂ ਤੁਹਾਡੀ ਕੰਪਨੀ ਓਲਾ ਤੋਂ ਕੈਬ ਬੁੱਕ ਕੀਤੀ ਸੀ ਤੁਹਾਡੀ ਕੰਪਨੀ ਦੀ ਏਜੰਸੀ ਨੂੰ ਮੈਂ ਪੇਸ਼ਗੀ ਭੁਗਤਾਨ ਵੀ ਕੀਤਾ ਹੈ ਪਰ ਹੁਣ ਮੇਰੇ ਘਰ ਵਿੱਚ ਇੱਕ ਮੁਸੀਬਤ ਆ ਗਈ ਹੈ ਅਸੀਂ ਕਿਸੇ ਦੇ ਵਿਆਹ 'ਤੇ ਜਾਣਾ ਸੀ ਅਸੀਂ ਇਸ ਕਰਕੇ ਕੈਬ ਬੁੱਕ ਕਰਵਾਈ ਸੀ ਪਰ ਹੁਣ ਅਚਾਨਕ ਮੇਰੇ ਮਾਤਾ ਜੀ ਦੀ ਤਬੀਅਤ ਬਹੁਤ ਹੀ ਮਾੜੀ ਹੋ ਗਈ ਹੈ ਮੇਰੇ ਮਾਤਾ ਜੀ ਵਿਆਹ 'ਤੇ ਨਹੀਂ ਜਾ ਸਕਦੇ ਜਿਸ ਕਰਕੇ ਅਸੀਂ ਉਹਨਾਂ ਨੂੰ ਇਕੱਲਾ ਨਹੀਂ ਛੱਡ ਕੇ ਜਾ ਸਕਦੇ ਇਸ ਕਰਕੇ ਹੁਣ ਅਸੀਂ ਕੈਬ ਰੱਦ ਕਰਵਾਉਣਾ ਚਾਹੁੰਦੇ ਹਾਂ ਜਿਸ ਕਰਕੇ ਮੈਨੂੰ ਕੈਬ ਰੱਦ ਕਰਾਉਣੀ ਪੈ ਰਹੀ ਹੈ ਅਤੇ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਰੱਦ ਕੀਤੀ ਕੈਬ ਲਈ ਬੈਂਕ ਵਿੱਚ ਰਿਫੰਡ ਟ੍ਰਾਂਸਫਰ ਕਰ ਦਿਉ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਮੇਰੇ ਪੈਸੇ ਪੇਅਟੀਐੱਮ ਜਾਂ ਗੂਗਲ ਪੇਅ ਰਾਹੀਂ ਪੈਸੇ ਵਾਪਸ ਕਰ ਦਿਉ ਮੈਂ ਤੁਹਾਡੀ ਬੜੀ ਅਭਾਰੀ ਰਹਾਂਗੀ ਮੇਰੀ ਬੁਕਿੰਗ ਆਈ ਡੀ ਦੋ ਤਿੰਨ ਇੱਕ ਦੋ ਚਾਰ ਹੈ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਤੁਸੀਂ ਮੈਨੂੰ ਕਿਸੇ ਵੀ ਤਰੀਕੇ ਮੇਰੇ ਪੈਸੇ ਵਾਪਸ ਕਰ ਸਕਦੇ ਹੋ ਤੁਸੀਂ ਮੈਨੂੰ ਪੇਅਟੀਐੱਮ ਰਾਹੀਂ ਮੇਰੇ ਪੈਸੇ ਵਾਪਸ ਕਰ ਸਕਦੇ ਹੋ ਤੁਸੀਂ ਮੈਨੂੰ ਗੂਗਲ ਰਾਹੀਂ ਮੇਰੇ ਪੈਸੇ ਵਾਪਸ ਕਰ ਸਕਦੇ ਹੋ ਤੁਸੀਂ ਮੇਰੇ ਬੈਂਕ ਖਾਤੇ ਵਿੱਚ ਵੀ ਵਾਪਸ ਕਰ ਸਕਦੇ ਹੋ ਅਤੇ ਮੇਰੀ ਬੁਕਿੰਗ ਆਈ ਡੀ ਵੀ ਚੈੱਕ ਕਰ ਸਕਦੇ ਹੋ ਤੋ ਸ ਸੋ ਕਿਰਪਾ ਕਰਕੇ ਮੈਨੂੰ ਜਲਦ ਤੋਂ ਜਲਦ ਮੇਰੇ ਪੈਸੇ ਵਾਪਸ ਕਰ ਦਿਉ ਮੈਨੂੰ ਇਸਦੀ ਬਹੁਤ ਹੀ ਲੋੜ ਹੈ ਮੈਂ ਆਪ ਜੀ ਦੀ ਬਹੁਤ ਹੀ ਜ਼ਿਆਦਾ ਅਭਾਰੀ ਹੋਵਾਂਗੀ ਜੇ ਤੁਸੀਂ ਮੈਨੂੰ ਮੇਰੇ ਪੈਸੇ ਵਾਪਸ ਕਰ ਦਿਉ ਧੰਨਵਾਦ